ਭਾਰਤੀ ਸਿਹਤ ਸੰਭਾਲ ਪ੍ਰਣਾਲੀ ਆ ਕਿਹੜੀ ਇਹ ਐਡੀ ਖਾਸ ਵਧੀਆ ਨਹੀਂ ਹੈ ਜਿਵੇਂ ਸਰਕਾਰੀ ਹੋਸਪੀਟਲ ਨੇ ਉਹ ਤਾਂ ਪਹਿਲਾਂ ਤਾਂ ਸਹੀ ਤਰੀਕੇ ਨਾਲ ਹੋਸਪਿਟਲ ਨਹੀਂ ਹਨ ਜੇ ਕੇ ਬੜੇ ਸ਼ਹਿਰਾਂ 'ਚ ਹੋਸਪਿਟਲ ਹੈਗੇ ਵੀ ਨੇ ਉੱਥੇ ਡਾਕਟਰਾਂ ਦੀ ਕਮੀ ਜ਼ਰੂਰ ਹੈ ਅਤੇ ਉਹ ਡਾਕਟਰ ਟਾਇਮ ਨਾਲ ਨਹੀਂ ਡਿਊਟੀ 'ਤੇ ਪਹੁੰਚਦੇ ਜੇ ਆਉਂਦੇ ਵੀ ਨੇ ਤਾਂ ਉਹ ਮਰੀਜ਼ਾਂ ਕਨੀ ਧਿਆਨ ਨਹੀਂ ਦਿੰਦੇ ਜਿਸ ਤਰਾਂ ਮਰੀਜ਼ ਸਵੇਰ ਤੋਂ ਲੈ ਕੇ ਆਪਣੀ ਸਲਿੱਪ ਕਟਾਉਣ ਲਈ ਲਾਈਨਾਂ ਲੱਗ ਜਾਂਦੇ ਨੇ ਤਾਂ ਉਹ ਅਦ ਘੰਟਾ ਘੰਟਾ ਦੋ ਦੋ ਘੰਟੇ ਲਾਈਨਾਂ 'ਚ ਹੀ ਲੱਗਿਆ ਰਹਿੰਦਾ ਮਰੀਜ਼ ਅਤੇ ਤਾਂ ਹੀ ਪਰਚੀ ਮਸਾਂ ਮਿਲਦੀ ਆ ਅਤੇ ਉੱਥੇ ਸਟਾਪ ਦੀ ਬਹੁਤ ਕਮੀ ਆ ਅਤੇ ਸਲਿੱਪ ਕਟਾਉਣ ਤੋਂ ਬਾਅਦ ਅੰਦਰ ਡਾਕਟਰ ਓ ਟੀ ਪੀ 'ਚ ਜਾਂਦਾ ਤਾਂ ਉੱਥੇ ਵੀ ਡਾਕਟਰਾਂ ਦੀ ਲਾਈਨਾਂ ਲੱਗ ਉਹ ਬਚ ਉਹ ਮਰੀਜ਼ਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਅਤੇ ਬਹੁਤ ਟਾਇਮ ਲੱਗ ਜਾਂਦਾ ਮਰੀਜ਼ ਨੂੰ ਖੜ੍ਹਨਾ ਪੈਂਦਾ ਅਤੇ ਨਾ ਹੀ ਕੋਈ ਸਫਾਈ ਹੈ ਤਾਂ ਆਪਾਂ ਦੂਜੇ ਪਾਸੇ ਦੇਖੀਏ ਪ੍ਰਾਈਵੇਟ ਹੋਸਟਲ ਹੋਸਪਿਟਲ ਕਨੀ ਤਾਂ ਉੱਥੇ ਸਫਾਈ ਵੀ ਹੁੰਦੀ ਆ ਡਾਕਟਰ ਵੀ ਹੁੰਦੇ ਨੇ ਵਧੀਆ ਪਰ ਉਹ ਛੋਟੇ ਰੋਗ ਨੂੰ ਵੱਡਾ ਰੋਗ ਦੱਸ ਕੇ ਬੜੇ ਪੈਸੇ ਕਮਾ ਰਹੇ ਨੇ ਪਰ ਆਮ ਬੰਦਾ ਗਰੀਬ ਬੰਦਾ ਹੁੰਦਾ ਜੋ ਉਹ ਆਪਣਾ ਸਹੀ ਤਰੀਕੇ ਨਾਲ ਉੱਥੇ ਇਲਾਜ ਨਹੀਂ ਕਰਵਾ ਸਕਦਾ ਪਰ ਅੰਤ ਮੈਂ ਆਪਣੀ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਵੀ ਜੋ ਇਹ ਸਿਹਤ ਸੰਬੰਧੀ ਹੋਸਪਿਟਲ ਨੇ ਇੱਥੇ ਸਭ ਤੋਂ ਵਧੀਆ ਮੁਹੱਈਆ ਕਰਵਾਉਣਾ ਚਾਹੀਦਾ ਹੈ